ਸਰਕਾਰ ਛੋਟੇ ਕਾਰੋਬਾਰਾ ਲਈ ਬੜੀ ਮੰਤ ਕਰਦੀ ਹੈ ਸਭ ਤੋਂ ਪਹਿਲਾਂ ਜਿਹੜੀ ਸਾਡੀ ਸਰਕਾਰ ਨੇ ਇੱਕ ਨਵੀਂ ਯੋਜਨਾ ਚਲਾਈ ਹੈ ਕਿ ਤੁਸੀਂ ਕੋਈ ਵੀ ਆਪਣਾ ਇੱਕ ਨਵਾਂ ਕਾਰੋਬਾਰ ਸ਼ੁਰੂ ਕਰ ਸਕਦੇ ਹੋ ਐਮ ਐਸ ਐਮ ਲੈ ਕੇ ਤੁਹਾਨੂੰ ਕੋਈ ਜੀ ਐਸ ਟੀ ਨੰਬਰ ਲੈਣ ਦੀ ਲੋੜ ਨਹੀਂ ਪੈਂਦੀ ਜਿਹਦੇ ਕਰਕੇ ਐਸ ਐਸ ਐਮ ਦੇ ਉੱਤੇ ਤੁਸੀਂ ਸਾਲ ਦੀ ਬਾਰਾਂ ਲੱਖ ਦੀ ਪੇਮੈਂਟ ਵਿਦਆਊਟ ਟੈਕਸ ਲੈ ਸਕਦੇ ਹੋ ਜਿਹੜਾ ਕਿ ਇੱਕ ਬਹੁਤ ਚੰਗਾ ਮੈਂ ਕਹਿਣਾ ਚਾਹੁੰਦਾ ਹਾਂ ਕਿ ਸਰਕਾਰ ਵੱਲੋਂ ਚੱਕਿਆ ਹੋਇਆ ਕਦਮ ਹੈ ਕਿ ਜਿਹੜੇ ਛੋਟੇ ਕਾਰੋਬਾਰ ਵਾਲੇ ਬੰਦੇ ਆ ਕਿ ਜਿਨਾਂ ਦੇ ਕੋਲ ਇੰਨੀ ਪੈਸੇ ਨਹੀਂ ਹੁੰਦੇ ਹੈਗੇ ਕਾਰੋਬਾਰ ਸ਼ੁਰੂ ਕਰਨ ਵਾਸਤੇ ਉਹਨਾਂ ਨੂੰ ਕੋਈ ਮਤਲਬ ਤੁਸੀਂ ਮੰਨ ਲਓ ਕਿ ਵੱਡੇ ਕਾਰੋਬਾਰ ਆ ਜਿੰਨੇ ਦੇ ਕੋਲ ਪੈਸੇ ਨਹੀਂ ਹੁੰਦੇ ਕਿ ਜਿੱਦਾਂ ਕਿ ਉਹ ਆਪਣੀ ਜਗ੍ਹਾ ਲੈ ਸਕਣ ਤੇ ਹੌਲੀ ਹੌਲੀ ਕਰਕੇ ਐਮ ਐਸ ਐਮ ਏ ਦੇ ਉੱਤੇ ਛੋਟੇ ਸਰਟੀਫਿਕੇਟ ਲੈ ਕੇ ਆਪਣਾ ਛੋਟਾ ਜਿਹਾ ਕਾਰੋਬਾਰ ਸ਼ੁਰੂ ਕਰ ਸਕਦੇ ਹਨ ਜਿਵੇਂ ਕਿ ਮੈਂ ਦੇਖਦਾ ਹਾਂ ਕਿ ਜਿੱਦਾਂ ਅੱਜ ਕੱਲ ਬਹੁਤ ਸਾਰੇ ਜਾਣੇ ਹੈ ਉਹ ਆਪਣੇ ਘਰੋਂ ਹੀ ਜਦੋਂ ਆਪਾਂ ਕਹਿ ਦਿੰਨੇ ਆ ਛੋਟੀ ਰਸੋਈ ਬਣਾ ਕੇ ਆਪਣਾ ਜਿਹੜਾ ਖਾਣਾ ਹੈ ਘਰੋ ਘਰੀ ਪਹੁੰਚਾਉਂਦੇ ਹਨ ਕਿ ਉਹਦੇ ਵਿੱਚ ਕੀ ਹੈ ਕਿ ਜਿਹੜਾ ਬੰਦਾ ਖਾਣਾ ਨਹੀਂ ਬਣਾ ਸਕਦਾ ਉਹਨੂੰ ਸਵੱਚ ਸਾਫ ਸੁਥਰਾ ਤੇ ਚੰਗਾ ਖਾਣਾ ਮਿਲ ਜਾਂਦਾ ਜਿਹੜਾ ਕਿ ਬਹੁਤ ਚੰਗੀ ਗੱਲ ਹੈ ਜਿਹੜਾ ਬੰਦੇ ਨੂੰ ਖਾਣਾ ਬਣਾਉਣਾ ਨਹੀਂ ਆਉਂਦਾ ਜਿਹੜੇ ਬੰਦੇ ਨੂੰ ਖਾਣਾ ਬਣਾਉਣਾ ਆਉਂਦਾ ਉਹ ਉਥੇ ਉਹਦੀ ਇੱਕ ਮਦਦ ਹੋ ਜਾਂਦੀ ਹੈ ਅਗਲੇ ਦੇ ਪੈਸੇ ਬਣ ਜਾਂਦੇ ਆ ਤੇ ਦੂਸਰੇ ਦੀ ਉਹ ਖਾਣਾ ਬਣਾਉਣ ਲਈ ਜਿਹੜੀ ਖੇਚਲ ਐ ਉਹ ਖਤਮ ਹੋ ਜਾਂਦੀ ਆ ਹੋਰ ਵੀ ਬਹੁਤ ਸਾਰੇ ਐਦਾ ਛੋਟੇ ਛੋਟੇ ਬਿਜਨਸ ਹੈ ਕਿ ਜਿੱਦਾਂ ਅੱਜ ਕੱਲ ਬਹੁਤ ਸਾਰੇ ਬੰਦੇ ਹੈ ਕਿ ਜਿਹੜੇ ਘਰੋ ਘਰੇ ਆਪਣਾ ਸਿਉਨ ਦਾ ਕੰਮ ਕਰਦੇ ਹੈ ਕੱਪੜੇ ਸੀਂਦੇ ਹੈ ਕੱਪੜੇ ਵੇਚਦੇ ਆ ਇਹ ਛੋਟੇ ਕਾਰੋਬਾਰ ਹੈਗੇ ਆ ਇਹਦੇ ਕਰਕੇ ਜਿਹੜੀ ਸਾਡੀ ਹੈ ਸਰਕਾਰ ਕਾਫੀ ਮਦਦ ਕਰਦੇ ਹੈ ਤੁਸੀਂ ਛੋਟੇ ਕਾਰੋਬਾਰ ਜੇ ਖੋਲਣਾ ਤੇ ਤੁਸੀਂ ਤੁਹਾਨੂੰ ਦੋ ਲੱਖ ਤਿੰਨ ਲੱਖ ਰੁਪਏ ਦਾ ਵਿਦਆਊਟ ਇੰਟਰਸਟ ਲੋਨ ਵੀ ਮਿਲ ਜਾਂਦਾ ਹੈ ਜਿਹੜੇ ਕਿ ਬਹੁਤ ਚੰਗੀ ਗੱਲ ਹੈ